ਰਸੋਈ ਦੇ ਵਿੱਚ ਬਹੁਤ ਸਾਰੇ ਭਾਂਡੇ ਹੁੰਦੇ ਹਨ ਇੱਕ ਤਾਂ ਹੁੰਦਾ ਹੈ ਤਵਾ ਤਵੇ ਦੇ ਉੱਪਰ ਆਪਾਂ ਰੋਟੀ ਬਣਾਉਂਦੇ ਹਨ ਅਤੇ ਇੱਕ ਹੁੰਦੀ ਹੈ ਕੜਾਹੀ ਕੜਾਹੀ ਦੇ ਵਿੱਚ ਆਪਾਂ ਪੂੜੀਆਂ ਵੀ ਤਲ ਸਕਦੇ ਹਨ ਸਬਜ਼ੀ ਵੀ ਬਣਾ ਸਕਦੇ ਹਨ ਮੈਗੀ ਵੀ ਬਣਾ ਸਕਦੇ ਹਨ ਇਸ ਦੇ ਨਾਲ ਇੱਕ ਹੁੰਦੀ ਹੈ ਕੜਛੀ ਕੜਛੀ ਬਹੁਤ ਟਾਈਪ ਦੀਆਂ ਹੁੰਦੀਆਂ ਸਨ ਇੱਕ ਇੱਕ ਹੁੰਦੀ ਹੈ ਬਿਲਕੁਲ ਪਲੇਨ ਕੜਛੀ ਇੱਕ ਹੁੰਦੀ ਹੈ ਪਲਟਾ ਇੱਕ ਹੁੰਦੀ ਹੈ ਨੋਰਮਲ ਕੜਛੀ ਆਪਾਂ ਨੋਰਮਲ ਕੜਛੀ ਨਾਲ ਸਬਜ਼ੀ ਬਣਾ ਸਕਦੇ ਹਨ ਇੱਕ ਦੇ ਇੱਕ ਹੁੰਦੀ ਹੈ ਜਾਲੀ ਜਾਲੀ ਨਾਲ ਆਪਾਂ ਪਕੌੜੇ ਕੱਢ ਸਕਦੇ ਹਨ ਇੱਕ ਹੁੰਦਾ ਹੈ ਪਲਟਾ ਪਲਟੇ ਨਾਲ ਆਪਾਂ ਕੁਛ ਵੀ ਆਮਲੇਟ ਵਗੈਰਾ ਪਲਟ ਸਕਦੇ ਹਾਂ ਇੱਕ ਹੁੰਦਾ ਹੈ ਆਮਲੇਟ ਪੈਨ ਤਵਾ ਆਮਲੇਟ ਵਾਲਾ ਤਵਾ ਉਹ ਵੀ ਬਹੁਤ ਵਧੀਆ ਹੁੰਦਾ ਹੈ ਇੱਕ ਹੁੰਦਾ ਹੈ ਚਮਚੇ ਚਮਚੇ ਆਪਾਂ ਨੂੰ ਤਿੰਨ ਚਾਰ ਟਾਈਪ ਦੇ ਮਿਲ ਜਾਂਦੇ ਹਨ ਜੋ ਕਿ ਵਧੀਆ ਹੁੰਦੇ ਹਨ ਆਪਾਂ ਕੋਲ ਗਲਾਸ ਵੀ ਆ ਜਾਂਦੇ ਹਨ ਕੱਚ ਦੇ ਗਲਾਸ ਵੀ ਆ ਜਾਂਦੇ ਹਨ ਗਲਾਸ ਕੱਚ ਦੇ ਸਟੀਲ ਦੇ ਪਲਾਸਟਿਕ ਦੇ ਗਲਾਸ ਵੀ ਆਪਣੇ ਰਸੋਈ 'ਚ ਹੁੰਦੇ ਹਨ ਕੌਲੀਆਂ ਕੌਲੇ ਅਤੇ ਛੋਟੀਆਂ ਕੌਲੀਆਂ ਵੀ ਆਪਾਂ ਨੂੰ ਰਸੋਈ ਘਰ ਵਿੱਚ ਮਿਲ ਜਾਂਦੀਆਂ ਹਨ ਪਲੇਟਾਂ ਪਲੇਟਾਂ ਵੀ ਬਹੁਤ ਸਾਰੀਆਂ ਟਾਈਪ ਦੀਆਂ ਹੁੰਦੀਆਂ ਹਨ ਜੋ ਕਿ ਆਪਾਂ ਰੋਟੀ ਵਿੱਚ ਪਰੋਸਣ ਦੇ ਵਿੱਚ ਵਰਤੋਂ ਕਰਦੇ ਹਨ ਪਲੇਟ ਦੇ ਵਿੱਚ ਆਪਾਂ ਇੱਕ ਕੌਲੀ ਇੱਕ ਪੰਜ ਸੱਤ ਰੋਟੀਆਂ ਨਾਲ ਕੁਛ ਆਚਾਰ ਵਗੈਰਾ ਵੀ ਰੱਖ ਸਕਦੇ ਹਨ ਇੱਕ ਹੁੰਦੀ ਹੈ ਛੋਟੀ ਪਲੇਟ ਜੋ ਕਿ ਓਨ ਇਕੱਲੀ ਰੋਟੀ ਨੂੰ ਵਰਤੀ ਜਾਂਦੀ ਹੈ ਇੱਕ ਹੁੰਦਾ ਹੈ ਵੱਡਾ ਥਾਲ ਥਾਲ ਦੇ ਵਿੱਚ ਆਪਾਂ ਕੁਛ ਵੀ ਰੱਖ ਸਕਦੇ ਹਨ ਆਪਾਂ ਜਿਵ ਆਪਾਂ ਚੌਲ ਬਣਾਏ ਚੌਲ ਵੀ ਆਪਾਂ ਰੱਖ ਸਕਦੇ ਹਨ ਆਪਣੇ ਰਸੋਈ ਦੇ ਵਿੱਚ ਕੂਕਰ ਵੀ ਹੁੰਦਾ ਹੈ ਕੂਕਰ ਦੇ ਨਾਲ ਆਪਾਂ ਚੌਲ ਕੁਛ ਚੌਲ ਕੁਛ ਵੀ ਆਲੂ ਉਬਾਲ ਸਕਦੇ ਹਨ ਰਸੋਈ ਘਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਅਤੇ ਬਹੁਤ ਚੰਗੀਆਂ ਚੀਜ਼ਾਂ ਹੁੰਦੀਆਂ ਹਨ ਰਸੋਈ ਘਰ ਦੇ ਵਿੱਚ ਬਰਤਨ ਨਾ ਹੋਣ 'ਤੇ ਰਸੋਈ ਘਰ ਸੁੰਨਾ ਸੁੰਨਾ ਲੱਗਦਾ ਹੈ ਸ਼ ਰਸੋਈ ਘਰ ਦੇ ਵਿੱਚ ਕੌਲੀ ਕੌਲੀਆਂ ਵੀ ਹੁੰਦੀਆਂ ਸਨ ਜੋ ਕਿ ਆਪਾਂ ਸਬਜ਼ੀ ਵਿੱਚ ਪਾਉਣ ਲਈ ਵਰਤੋਂ ਕਰਦੇ ਹਨ ਰਸੋਈ ਘਰ ਦੇ ਵਿੱਚ ਇੱਕ ਟੋਪੀਆ ਵੀ ਹੁੰਦਾ ਹੈ ਜੋ ਕਿ ਆਪਾਂ ਚਾਹ ਬਣਾਉਣ ਲਈ ਕੰਮ ਲਿਆਉਂਦੇ ਹਨ ਇੱਕ ਰਸੋਈ ਘਰ ਦੇ ਵਿੱਚ ਚਾਹ ਪੁਣਨੀ ਵੀ ਹੁੰਦੀ ਹੈ ਜੋ ਕਿ ਆਪਾਂ ਚਾਹ ਨੂੰ ਪੁਣ ਕੇ ਆਪਾਂ ਗਲਾਸ ਦੇ ਵਿੱਚ ਪਾਉਂਦੇ ਹਨ